ਸਾਡੇ ਖੇਤਰ ਦੇ ਵਿੱਚ ਇੱਕ ਸਿਨਮਾ ਥੀਏਟਰ ਬਹੁਤ ਮਸ਼ਹੂਰ ਹੈ ਜਿਹਦਾ ਨਾਂ ਹੈ ਸਤਲੁਜ ਸਿਨਮਾ ਮੈਂ ਅਕਸਰ ਜਿਹੜੀ ਨਵੀਂ ਫਿਲਮ ਜਿਹੜੀ ਕਿ ਦੇਖਣ ਯੋਗ ਹੁੰਦੀ ਹੈ ਸਾਨੂੰ ਲੱਗਦੀ ਹੈ ਵੀ ਦੇਖਣ ਯੋਗ ਹੈ ਉਹ ਦੇਖਣ ਲਈ ਉੱਥੇ ਸਤਲੁਜ ਸਿਨਮਾ ਵਿੱਚ ਜਾਂਦਾ ਹਾਂ ਅਤੇ ਮੈਂ ਆਪਣੇ ਜ਼ਿਆਦਾਤਰ ਆਪਣੇ ਪਰਿਵਾਰ ਨਾਲ ਅਤੇ ਕਦੇ ਕਦੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਉੱਥੇ ਜਾਣਾ ਪਸੰਦ ਕਰਦਾ ਹਾਂ